ਮੇਰੇ ਮੁਤਾਬਿਕ ਜੋ ਯੋਗਾ ਹੈ ਉਹ ਹਰ ਇੱਕ ਵਿਅਕਤੀ ਹਰ ਨਾਗਰਿਕ ਹਰ ਸ਼ਹਿਰ ਹਰ ਸਟੇਟ ਹਰ ਦੇਸ਼ ਔਰ ਪੂਰੇ ਸੰਸਾਰ ਵਾਸਤੇ ਬਹੁਤ ਜ਼ਰੂਰੀ ਆ ਔਰ ਜੇਕਰ ਅਸੀਂ ਪੂਰੇ ਸੰਸਾਰ ਨੂੰ ਰੋਗ ਮੁਕਤ ਕਰਨਾ ਤਾਂ ਯੋਗਾ ਸਿਖਾਉਣਾ ਬਹੁਤ ਜ਼ਰੂਰੀ ਆ ਸੋ ਮੈਨੂੰ ਲੱਗਦਾ ਕਿ ਯੋਗਾ ਸਭ ਤੋਂ ਪਹਿਲਾਂ ਬੱਚਿਆਂ ਦੇ ਸਕੂਲ ਦੇ ਸਿਲੇਬਸ ਵਿੱਚ ਹੋਣਾ ਚਾਹੀਦਾ ਜਿਸ ਕਾਰਨ ਬੱਚਿਆਂ ਨੂੰ ਯੋਗਾ ਬਾਰੇ ਪਤਾ ਲੱਗ ਸਕੇ ਯੋਗਾ ਦੇ ਫਾਇਦੇ ਪਤਾ ਲੱਗ ਸਕਣ ਔਰ ਯੋਗਾ ਕਰਨਾ ਕਿਵੇਂ ਆ ਇਹ ਪਤਾ ਲੱਗ ਸਕੇ ਕਿਉਂਕਿ ਜਿਵੇਂ ਅਸੀਂ ਜਾਣਦੇ ਹਾਂ ਕਿ ਜਿਹੜੇ ਬੱਚੇ ਹੁੰਦੇ ਆ ਉਹ ਇੱਕ ਕੋਰੇ ਪੇਪਰ ਦੀ ਤਰ੍ਹਾਂ ਹੁੰਦੇ ਆ ਉਹਨਾਂ ਉੱਤੇ ਜੋ ਵੀ ਲਿਖਿਆ ਜਾਏ ਉਹ ਉਸੇ ਚੀਜ਼ ਨੂੰ ਫਿਰ ਡਿਵੈਲਪ ਕਰ ਲੈਂਦੇ ਆ ਸੋ ਮੈਨੂੰ ਲੱਗਦਾ ਕਿ ਬੱਚਿਆਂ ਦੇ ਸਿਲੇਬਸ ਵਿੱਚ ਜੇਕਰ ਅਸੀਂ ਯੋਗਾ ਕੰਪਲਸਰੀ ਸਬਜੈਕਟ ਅਸੀਂ ਇੱਕ ਪਾ ਕੇ ਅਤੇ ਯੋਗਾ ਨੂੰ ਅਸੀਂ ਅੱਗੇ ਲਿਆ ਸਕਦੇ ਹਾਂ ਜਿਹਦੇ ਕਾਰਨ ਸਾਡਾ ਦੇਸ਼ ਸਾਡਾ ਸਮਾਜ ਸਾਡਾ ਰਾਸ਼ਟਰ ਸਾਡਾ ਸੰਸਾਰ ਜਿਹੜਾ ਯੋਗ ਮੁਕਤ ਹੋ ਸਕਦਾ ਕਿਉਂਕਿ ਜਿਵੇਂ ਅਸੀਂ ਜਾਣਦੇ ਹਾਂ ਕਿ ਅੱਜ ਕੱਲ੍ਹ ਦੇ ਸਮਾਜ ਦੇ ਵਿੱਚ ਖਾਣ ਪੀਣ ਦੇ ਕੁਝ ਇਸ ਤਰ੍ਹਾਂ ਦੇ ਚਾਲ ਚਲਣ ਚਲ ਗਏ ਨੇ ਜੋ ਕਿ ਸਾਡੇ ਸਰੀਰ ਨੂੰ ਦਿਨ ਬ ਦਿਨ ਬਿਮਾਰੀਆਂ ਵੱਲ ਲੈ ਕੇ ਜਾ ਰਹੇ ਨੇ ਸਾਡਾ ਖਾਣ ਪਾਣ ਬਹੁਤ ਗਲਤ ਹੋ ਚੁੱਕਿਆ ਜਿਸ ਕਰਕੇ ਸਾਡੇ ਸਰੀਰ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਜਕੜ ਰਹੀਆਂ ਨੇ ਸੋ ਜੇਕਰ ਅਸੀਂ ਯੋਗਾ ਨੂੰ ਬੱਚਿਆਂ ਦੇ ਸਿਲੇਬਸ ਵਿੱਚ ਜਾਂ ਬੱਚਿਆਂ ਦੇ ਪਾਲਣ ਪੋਸ਼ਣ ਵਿੱਚ ਉਹਨਾਂ ਦੇ ਯੋਗਾਂ ਦੇ ਸਿਧਾਂਤ ਅਸੀਂ ਲਾਵਾਂਗੇ ਤਾਂ ਉਹ ਤੋਂ ਮੈਨੂੰ ਲੱਗਦਾ ਕਿ ਇਹਦੇ ਨਾਲ ਸਾਡੇ ਜਿਹੜੇ ਬੱਚੇ ਆ ਉਹਨਾਂ ਨੂੰ ਵੀ ਇੱਕ ਨਵੀਂ ਦਿਸ਼ਾ ਮਿਲ ਸਕਦੀ ਹੈ ਔਰ ਜ਼ਿੰਦਗੀ ਕਿਵੇਂ ਬਤੀਤ ਕਰਨੀ ਆ ਉਹਦੇ ਵਿੱਚ ਬੱਚਿਆਂ ਨੂੰ ਮਦਦ ਮਿਲ ਸਕਦੀ ਹੈ ਸੋ ਮੈਨੂੰ ਲੱਗਦਾ ਕੀ ਯੋਗਾ ਦੇ ਸਿਧਾਂਤ ਜਿਹੜੇ ਆ ਉਹਨੂੰ ਸਿੱਖਿਆ ਵਿੱਚ ਸ਼ਾਮਿਲ ਕਰਨਾ ਬਹੁਤ ਜ਼ਰੂਰੀ ਹੈ